ਹਾਈਕਿੰਗ ਅਤੇ ਟਰੈਕਿੰਗ ਅੱਜ ਕੱਲ੍ਹ ਲੋਕਾਂ ਦਾ ਇੱਕ ਸ਼ੌਂਕ ਬਣ ਚੁੱਕਿਆ ਏ ਕਿਉਂਕਿ ਅੱਜ ਕੱਲ੍ਹ ਬਹੁਤ ਸਾਰੇ ਲੋਕ ਆ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਕਿ ਉਹ ਟਰੈਕਿੰਗ ਜਾਂ ਹੈਕਿੰਗ ਕਰਨ ਵਾਸਤੇ ਹਿਲ ਸਟੇਸ਼ਨਸ ਆਊਟਿੰਗ ਕਰਨ ਦੀ ਬਹੁਤ ਸਾਰੇ ਲੋਕ ਬਾਹਰ ਜਾਂਦੇ ਨੇ ਜੀ ਹਾਈਕਿੰਗ ਅਤੇ ਟਰੈਕਿੰਗ ਦੇ ਮੁੱਢਲੇ ਰੂਲ ਇਹੀ ਹੋਣੇ ਚਾਹੀਦੇ ਕਿ ਇੱਕ ਆਦਮੀ ਜਾਂ ਔਰਤ ਕੋਈ ਵੀ ਹੈ ਟੈਕਿੰਗ ਕਰਨ ਜਾਂਦਾ ਹੈਕਿੰਗ ਕਰਨ ਜਾਂਦਾ ਹੈ ਤਾਂ ਉਸ ਨੂੰ ਆਪਣੇ ਫੁੱਲ ਸੇਫਟੀ ਦੇ ਨਾਲ ਚੱਲਣਾ ਚਾਹੀਦਾ ਫਸਟ ਆਫ ਆਲ ਪਹਿਲੀ ਗੱਲ ਤਾਂ ਇਹ ਹੈ ਕਿ ਉਹਨੂੰ ਆਪਣੇ ਸੇਫਟੀ ਸੂਜ ਸੇਫਟੀ ਜੈਕਟ ਅਤੇ ਸੇਫਟੀ ਹੈਲਮਟ ਇਹ ਤਿੰਨ ਚੀਜ਼ਾਂ ਦੀ ਤਾਂ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਨਾ ਉਹ ਤੋਂ ਇਲਾਵਾ ਇੱਕ ਉਹਦੇ ਕੋਲ ਹੱਥ ਦੇ ਵਿੱਚ ਸਟਿਕ ਹੋਣੀ ਚਾਹੀਦੀ ਹੈ ਕਿ ਜਦੋਂ ਚੜਾਈ ਦੇ ਉੱਪਰ ਚੜ੍ਹੇ ਤਾਂ ਇੱਕ ਉਹਦੇ ਕੋਲ ਜਿਹਨੂੰ ਕਹਿੰਦੇ ਆ ਕਿ ਆਪਣਾ ਉਹ ਹੋਵੇ ਸਾਧਨ ਹੋਵੇ ਜਿਸ ਉੱਤੇ ਆਪਣਾ ਉਹ ਭਾਰ ਪਾ ਸਕੇ ਉਸ ਤੋਂ ਬਾਅਦ ਹਾਈਕਿੰਗ ਦੇ ਹਾਈਕਿੰਗ ਵਾਸਤੇ ਉਹਦੇ ਕੋਲ ਆਪਣਾ ਇੱਕ ਫੁੱਲ ਪਰੂਫ ਜਿਹਨੂੰ ਕਹਿੰਦੇ ਆ ਕਿ ਆਪਣਾ ਸੇਫਟੀ ਬੈਲਟ ਹੋਣੀ ਚਾਹੀਦੀ ਆ ਜਿਹਨੂੰ ਕਹਿੰਦੇ ਆ ਕਿ ਸੇਫਟੀ ਦੀ ਕੁੰਡੀਆਂ ਹੋਣੀਆਂ ਚਾਹੀਦੀਆਂ ਹਰ ਇੱਕ ਉਹਦੇ ਕੋਲ ਆਪਣਾ ਸੇਫਟੀ ਚੀਜ਼ਾਂ ਹੋਣੀ ਚਾਹੀਦੀਆਂ ਦੈਨ ਫੇਰ ਉਹ ਹਾਈਕਿੰਗ ਕਰ ਸਕਦਾ ਆ ਇਹ ਸਭ ਚੀਜ਼ਾਂ ਨੇ ਜਿਹੜੀਆਂ ਹਾਈਕਿੰਗ ਅਤੇ ਟਰੈਕਿੰਗ ਦੇ ਮੁੱਢਲੇ ਰੂਲ ਹਨ ਹਾਂਜੀ ਇਹਨਾਂ ਨੂੰ ਧਿਆਨ ਰੱਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ